ਹਾਂਜੀ ਅਸੀਂ ਆਂਢ ਗੁਆਂਢ ਦੇ ਘਰਾਂ ਬਾਰੇ ਜਾਣਦੇ ਹਾਂ ਜੋ ਕਿ ਸੈਲਾਨੀਆਂ ਨੂੰ ਆਪਣੇ ਘਰ ਸਾ ਰੱਖਦੇ ਹਨ ਅਤੇ ਚੰਗਾ ਭੋਜਨ ਵੀ ਛਕਾਉਂਦੇ ਹਨ ਸਾਡੇ ਘਰ ਦੇ ਲਾਗੇ ਕਈ ਸੇਵਾ ਪ੍ਰਧਾਨ ਵੀ ਹਨ ਅਤੇ ਹੋਟਲ ਵੀ ਹਨ ਧਰਮਸ਼ਾਲਾ ਵੀ ਹਨ ਜਿੱਥੇ ਕਿ ਸੈਲਾਨੀ ਆਉਂਦੇ ਹਨ ਅਤੇ ਉੱਥੇ ਠਹਿਰਦੇ ਹਨ ਸਾਡੇ ਦਰਬਾਰ ਸਾਹਿਬ ਕਈ ਲੋਕ ਸਰਾਵਾਂ ਵਿੱਚ ਵੀ ਠਹਿਰਦੇ ਹਨ